ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਦ ਕਿ ਪੇਂਡੂ ਭਾਈਚਾਰੇ ਵਿੱਚ ਖੇਤੀਬਾੜੀ ਦਾ ਆਯੋਗ ਦਾ ਸੁਧਾਰ ਪਹਿਲੇ ਨੰਬਰ 'ਤੇ ਸਾਨੂੰ ਤਾਂ ਖੇਤ ਦੀ ਕੇਅਰ ਕਰਨੀ ਚਾਹੀਦੀ ਹੈ ਇੱਕ ਨੰਬਰ 'ਤੇ ਪਹਿਲਾਂ ਖੇਤ ਨੂੰ ਚਾਰੋਂ ਤ ਚਾਰੋਂ ਸਾਈਡ ਤੋਂ ਘੇਰਾ ਬਣਾਉਣਾ ਚਾਹੀਦਾ ਹੈ ਜਾਂ ਉਸ ਦੀ ਬੋਟੜੀ ਲਗਾਉਣੀ ਚਾਹੀਦੀ ਹੈ ਤਾਂ ਜੋ ਉਸ ਵਿੱਚ ਕੋਈ ਜੰਗਲੀ ਜਾਨਵਰ ਜਾਂ ਪਸ਼ੂ ਨਾ ਆ ਸਕੇ ਔਰ ਨੰਬਰ ਦੋ 'ਤੇ ਸਾਨੂੰ ਉਸ ਦੀ ਅੱਛੀ ਤਰ੍ਹਾਂ ਕੇਅਰ ਕਰਨੀ ਚਾਹੀਦੀ ਹੈ ਅਤੇ ਉਸ ਦੀ ਅੱਛੀ ਤਰ੍ਹਾਂ ਵਹਾਈ ਕਰਨੀ ਚਾਹੀਦੀ ਹੈ ਉਸ ਵਿੱਚ ਨਾ ਕੋਈ ਘਾਹ ਘੂਹ ਐਰਾ ਨਾ ਹੋ ਸਕੇ ਨੰਬਰ ਦੋ ਸਾਨੂੰ ਉਸ ਵਿੱਚ ਅੱਛੀ ਤਰ੍ਹਾਂ ਪਾਣੀ ਲਗਾਉਣਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਲਗਾਉਣ ਵਾਲੀ ਫਸਲ ਸਹੀ ਤਰ੍ਹਾਂ ਦੀ ਨਿਕਲ ਸਕੇ ਹੋਰ ਸਾਨੂੰ ਫਸਲ ਲਾਉਣ ਵਿੱਚ ਅੱਛੀ ਤੋਂ ਅੱਛੀ ਖਾਦ ਦਾ ਵੀ ਉਪਯੋਗ ਕਰਨਾ ਚਾਹੀਦਾ ਹੈ ਜੋ ਇਸ ਦਾ ਟਾਈਮ ਸਿਰ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਫਸਲ ਅੱਛੀ ਤਰ੍ਹਾਂ ਨਿਕਲ ਸਕੇ ਇੱਕ ਫਸਲ ਅੱਛੀ ਤਰ੍ਹਾਂ ਹੋ ਸਕੇ ਔਰ ਸਾਨੂੰ ਉਸ ਫਸਲ ਨਾਲ ਕੋਈ ਵੀ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਪੇਂਡੂ ਪਚਾ ਭਾਈਚਾਰੇ ਵਿੱਚ ਖੇਤੀ ਦਾ ਅੱਛੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ